ਕਾਜੂ ਕਤਲੀ ਬਰਫੀ ਗੁਲਾਬ ਜਾਮੁਣ ਇਮਰਤੀ ਰਸਗੁੱਲਾ ਰਸਮਲਾਈ ਸੋਨ ਪਾਪੜੀ ਮੋਦਕ ਰਬੜੀ ਬਾਲੂ ਸ਼ਾਹੀ ਬੇਸਣ ਲੱਡੂ ਸ਼ਰੀਕੰਦ ਬੂੰਦੀ ਕਲਾਕੰਦ ਨਾਨਖਟਾਈ